ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਸਾਡੀ ਮਾਂ ਬੋਲੀ ਆ ਪੰਜਾਬੀ ਭਾਸ਼ਾ ਹਰੇਕ ਬੱਚੇ ਨੂੰ ਛੋਟੇ ਤੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਆਪਣੀ ਮਾਤ ਭਾਸ਼ਾ ਹੀ ਸਿੱਖਦੇ ਹਾਂ ਜਿਵੇਂ ਕਿ ਪੰਜਾਬੀ ਆ ਅਸੀਂ ਆਪਣੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਅਸੀਂ ਆਪਣੀ ਮਾਂ ਭਾਸ਼ਾ ਨੂੰ ਸਿੱਖਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਅਸੀਂ ਸਕੂਲ ਦੇ ਵਿੱਚ ਜਾਂਦੇ ਹਾਂ ਉੱਥੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਸਿੱਖਦੇ ਹਾਂ ਪਰ ਸਕੂਲ ਤੋਂ ਬ ਅ ਸਕੂਲ ਤੋਂ ਬਾਅਦ ਜਦੋਂ ਬੱਚੇ ਹੈ ਜੋ ਆਪਣੇ ਫਰੈਂਡਸ ਹੈ ਉਹਨਾਂ ਨਾਲ ਖੇਡਦੇ ਕਰਦੇ ਆ ਤਾਂ ਅੱਜ ਕੱਲ੍ਹ ਰੁਝਾਨ ਹੋ ਗਿਆ ਆ ਜ਼ਿਆਦਾ ਅੰਗਰੇਜ਼ੀ ਇੰਗਲਿਸ਼ ਵੱਲ ਰੁਝਾਨ ਥੋੜ੍ਹਾ ਬੱਚਿਆਂ ਦਾ ਜ਼ਿਆਦਾ ਹੋ ਗਿਆ ਆ ਪਰ ਮਾਂ ਬੋਲੀ ਆ ਜੋ ਉਹਨੂੰ ਨਹੀਂ ਭੁੱਲਣਾ ਚਾਹੀਦਾ ਮਾਂ ਬੋਲੀ ਨੂੰ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਆ ਮਾਂ ਬੋਲੀ ਦੇ ਨਾਲ ਜ਼ਰੀਏ ਹੀ ਅਸੀਂ ਆਪਣੇ ਸੱਭਿਆਚਾਰ ਨੂੰ ਅਸੀਂ ਆਪਣੇ ਦਿਲ ਦੀ ਗੱਲਾਂ ਨੂੰ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ ਮਾਂ ਬੋਲੀ ਸਾਡੇ ਲਈ ਬਹੁਤ ਜ਼ਰੂਰੀ ਹੈ ਮਾਤ ਭਾਸ਼ਾ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਪੰਜਾਬੀ ਭਾਸ਼ਾ ਆ ਜੋ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਹੈ ਕਿਉਂਕਿ ਸਾਡੇ ਗੁਰੂਆਂ ਪੀਰਾਂ ਉਸ ਤ ਉਸ ਟਾਈਮ ਤੋਂ ਮਤਲਬ ਮਾਤ ਭਾਸ਼ਾ ਜਿਹੜੀ ਸਾਡੀ ਹੈਗੀ ਪੰਜਾਬੀ ਉਹ ਚੱਲੀ ਆ ਰਹੀ ਆ ਅਤੇ ਸਾਡੇ ਗ੍ਰੰਥ ਆ ਜੋ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਿਖੇ ਗਏ ਹੈ ਇਸ ਲਈ ਮਾਤ ਭਾਸ਼ਾ ਨੂੰ ਸਿੱਖਣਾ ਬਹੁਤ ਜ਼ਰੂਰੀ ਆ ਅਤੇ ਅਸੀਂ ਮਾਤ ਭਾਸ਼ਾ ਸਿੱਖ ਕੇ ਹੀ ਆਪਣੇ ਜੋ ਇਤਿਹਾਸ ਨੂੰ ਜਾਣ ਸਕਦੇ ਹਾਂ